ਹੈਲੋ ਹਾਂਜੀ ਹਾਂਜੀ ਅੱਛਾ ਅੱਛਾ ਹਾਂਜੀ ਮੈਮ ਮੈਨੂੰ ਦੱਸਿਆ ਸੀਗਾ ਕਮਲ ਨੇ ਹਾਂਜੀ ਮੈਮ ਤੁਸੀਂ ਟੂਰਿਜਮ ਮਤਲਬ ਘੁੰਮਣ ਵਗੈਰਾ ਲਈ ਆਏ ਹੋ ਅੱਛਾ ਅੱਛਾ ਮੈਮ ਮਤਲਬ ਪੰਜਾਬ ਦੇ ਜਿਹੜੇ ਟਰਾਂਸਪੋਰਟ ਸਿਸਟਮ ਹੈ ਮਤਲਬ ਕੁਛ ਇੰਨਾਂ ਕੁਛ ਵਧੀਆ ਵੀ ਨਹੀਂ ਹੈਗਾ ਮਤਲਬ ਠੀਕ ਠੀਕ ਹੀ ਹੈ ਇੰਨਾਂ ਕੁਛ ਜ਼ਿਆਦਾ ਵਧੀਆ ਵੀ ਨਹੀਂ ਹੈ ਮਤਲਬ ਠੀਕ ਠੀਕ ਹੀ ਹੈ ਜਿੱਦਾਂ ਕਿ ਤੁਸੀਂ ਹੁਣ ਘੁੰਮਣ ਦੇ ਲਈ ਜਿੱਦਾਂ ਕੋਈ ਵੀ ਤੁਸੀਂ ਬੱਸਾਂ ਵਗੈਰਾ ਦਾ ਦੇਖ ਲਓ ਪੰਜਾਬ ਦੇ ਵਿੱਚ ਬੱਸਾਂ ਦਾ ਜਿੱਦਾਂ ਕਿ ਬੱਸਾਂ ਜਿਹੜੀਆਂ ਹੁਣ ਤੁਸੀਂ ਪੰਜਾਬ 'ਚ ਪੰਜਾਬ ਰੋਡਵੇਜ਼ ਬੱਸਾਂ ਹੀ ਲਗਾ ਲਓ ਮਤਲਬ ਇਹਦੇ ਵਿੱਚ ਨਾ ਕੋਈ ਸਹੂਲੀਅਤ ਨਹੀਂ ਹੈ ਮਤਲਬ ਜਿੱਦਾਂ ਹੁਣ ਅੱਜ ਕੱਲ੍ਹ ਪੰਜਾਬ ਸਰਕਾਰ ਨੇ ਜਿਹੜਾ ਕਿਰਾਇਆ ਏ ਉਹ ਲੇਡੀਜ ਦਾ ਫਰੀ ਕਰਤਾ ਵਾ ਨਾ ਜਿੱਦਾਂ ਆਧਾਰ ਕਾਰਡ ਦਿਖਾਓ ਅਤੇ ਫਿਰ ਕਿਰਾਇਆ ਨਹੀਂ ਲੱਗਦਾ ਅਤੇ ਇਹਦੇ ਕਰਕੇ ਨਾ ਮਤਲਬ ਬਹੁਤ ਜ਼ਿਆਦਾ ਬੱਸਾਂ ਦੇ ਵਿੱਚ ਰੱਸ਼ ਹੋ ਗਿਆ ਵਾ ਉਹਨਾਂ ਨੂੰ ਬਣਦਾ ਕੁਝ ਹੈ ਨਹੀਂ ਹੈ ਅਤੇ ਉਹਦੇ ਕਰਕੇ ਡਰਾਈਵਰ ਉਹ ਕੰਡਕਟਰ ਬਹੁਤ ਜ਼ਿਆਦਾ ਖਿਝੇ ਚਿੜੇ ਵੇ ਰਹਿੰਦੇ ਉਹਦੇ ਕਰਕੇ ਫਿਰ ਉਹ ਬੱਸਾਂ ਰੋਕਦੇ ਨਹੀਂ ਹੈਗੇ ਜਾਂ ਫਿਰ ਪੂਰੇ ਪੂਰੇ ਬੱਸ ਸਟੈਂਡ 'ਤੇ ਰੋਕਦੇ ਆ ਫਿਰ ਪਹਿਲਾਂ ਚਲਾ ਲੈਂਦੇ ਕਿਤੇ ਖੜ੍ਹਾਂਦੇ ਨਹੀਂ ਹੈਗੇ ਪ੍ਰੋਪਰ ਸਵਾਰੀਆਂ ਦਾ ਮਤਲਬ ਕੋਈ ਉਹਦੇ ਵਿੱਚ ਨਾ ਪ੍ਰੋਪਰ ਨਾ ਕੋਈ ਸਹੂਲੀਅਤ ਨਹੀਂ ਹੈਗੀ ਮਤਲਬ ਸੇਫਟੀ ਨਹੀਂ ਹੈਗੀ ਕੋਈ ਕਹਿ ਲਓ ਅਤੇ ਹਾਂਜੀ ਹਾਂਜੀ ਮੈਮ ਜਿੱਦਾਂ ਹੁਣ ਤੁਸੀਂ ਉਹਦੇ ਵਿੱਚ ਲਗਾ ਲਓ ਹਾਂਜੀ ਜੇ ਤੁਸੀਂ ਰੇਲ ਦਾ ਕਹਿ ਰਹੇ ਹੋ ਟਰੇਨਸ ਵਗੈਰਾ 'ਚ ਟਰੇਨ ਮਤਲਬ ਹੈਗੀਆਂ ਤਾਂ ਹੈ ਪਰ ਉਹਦਾ ਨਾ ਜਿੱਦਾਂ ਕਿ ਤੁਸੀਂ ਦੇਖ ਲਓ ਜਿੱਦਾਂ ਮਤਲਬ ਕਿ ਲੋਕਲ ਹੈ ਮਤਲਬ ਜਿੱਦਾਂ ਹੁਣ ਤੁਸੀਂ ਕਿਤੇ ਵੀ ਤੁਸੀਂ ਜਾਣਾ ਜਿੱਦਾਂ ਹੁਣ ਤੁਸੀਂ ਮੈਮ ਕਪੂਰਥਲਾ ਦੇਖ ਲਓ ਹੈ ਨਾ ਕਪੂਰਥਲਾ 'ਚ ਤੁਸੀਂ ਟ੍ਰੇਨ ਵਗੈਰਾ ਵੀ ਲਉਗੇ ਤਾਂ ਤੁਹਾਨੂੰ ਮਤਲਬ ਵਿੱਚ ਵਿੱਚ ਕਿਤੇ ਵੀ ਪਿੰਡਾਂ 'ਚ ਟ੍ਰੇਨ ਨਹੀਂ ਮਿਲੇਗੀ ਤੁਹਾਨੂੰ ਮੇਨ ਮੇਨ ਮਤਲਬ ਮੇਨ ਮੇਨ ਜਗ੍ਹਾ 'ਤੇ ਹੀ ਟ੍ਰੇਨ ਮਿਲੇਗੀ ਮਤਲਬ ਜਿਹੜੀ ਟ੍ਰੇਨਾਂ ਦੀ ਸਰਵਿਸ ਹੈ ਨਾ ਉਹ ਲੋਕਲ ਨਹੀਂ ਹੈਗੀ ਹੈ ਜਿੱਦਾਂ ਹੈਗੀ ਤਾਂ ਹੈ ਪਰ ਲੋਕਲ ਨਹੀਂ ਹੈਗੀ ਹੈ ਥੋੜ੍ਹਾ ਖਰਚਾ ਵੀ ਟਰੇਨ ਦਾ ਘੱਟ ਹੁੰਦਾ ਬਟ ਫਿਰ ਵੀ ਲੋਕਲ ਥੋੜ੍ਹੀ ਹੈ ਟ੍ਰੇਨਾਂ ਉਹ ਤੁਸੀਂ ਹੋਰ ਜਾਂ ਮਤਲਬ ਜੇ ਤੁਸੀਂ ਏਅਰ ਦੇ ਵੇਅ ਤੋਂ ਜਾਓਗੇ ਕਿਤੇ ਵੀ ਫਿਰ ਉਹ ਮਤਲਬ ਅਫੋਡ ਨਹੀਂ ਕਰ ਸਕਦਾ ਮਤਲਬ ਥੋੜ੍ਹੇ ਮਤਲਬ ਗਰੀਬ ਬੰਦੇ ਕਿਉਂਕਿ ਉਹਨਾਂ ਦਾ ਖਰਚਾ ਜ਼ਿਆਦਾ ਹੋ ਜਾਂਦਾ ਹੈ ਹਾਂਜੀ ਮੈਮ ਜਿੱਦਾਂ ਮੈਮ ਤੁਸੀਂ ਜਾਓਗੇ ਉਹਦੇ ਵਿੱਚ ਜਾਓਗੇ ਕਿਆ ਕਹਿੰਦੇ ਹੁੰਦੇ ਉਹਨੂੰ ਜਿੱਦਾਂ ਤੁਸੀਂ ਹਾਂਜੀ ਏਅਰ ਦੇ ਵਿੱਚ ਜਾਓਗੇ ਤਾਂ ਤੁਸੀਂ ਪਹਿਲਾਂ ਏਅਰਪੋਰਟ ਤੱਕ ਕਿਸੇ ਬੱਸ ਵਿੱਚ ਜਾਓਗੇ ਜਾਂ ਟਰੇਨ 'ਚ ਜਾਓਗੇ ਤਾਂ ਤੁਸੀਂ ਉੱਥੇ ਤੱਕ ਖਰਚਾ ਕਰਕੇ ਜਾਓਗੇ ਦੂਜਾ ਤੁਸੀਂ ਇ ਜਹਾਜ 'ਚ ਜਾਓਗੇ ਤਾਂ ਉੱਥੇ ਤੁਹਾਡਾ ਖਰਚਾ ਹੋਵੇਗਾ ਇੱਦਾਂ ਮਤਲਬ ਤੁਹਾਡਾ ਜ਼ਿਆਦਾ ਹਾਂਜੀ ਹਾਂਜੀ ਮੈਮ ਫਿਰ ਤੁਹਾਡਾ ਜ਼ਿਆਦਾ ਖਰਚਾ ਹੋਜੂ ਮਤਲਬ ਠੀਕ ਹੈ ਟ੍ਰਾਂਸਪੋਰਟ ਸਿਸਟਮ ਕੁਛ ਇੰਨਾਂ ਕੁਛ ਜ਼ਿਆਦਾ ਵਧੀਆ ਨਹੀਂ ਹੈਗਾ ਹੈ ਬੱਸਾਂ ਦੇ ਵਿੱਚ ਵੀ ਧੱਕੇ ਹੀ ਮਿਲਦੇ ਆ ਵੈਸੇ ਹਲੇ ਜੇ ਦੇਖੀਏ ਨਾ ਪ੍ਰਾਈਵੇਟ ਬੱਸਾਂ ਪ੍ਰਾਈਵੇਟ ਬੱਸਾਂ ਦੇ ਵਿੱਚ ਵਧੀਆ ਏ ਪ੍ਰਾਈਵੇਟ ਬੱਸਾਂ ਹਰ ਇੱਕ ਥਾਂ ਦੇ ਉੱਤੇ ਰੁਕਦੀਆਂ ਵੀ ਹੈਗੀਆਂ ਏ ਇਹ ਸਵਾਰੀਆਂ ਨੂੰ ਲੈਂਦੀਆਂ ਵੀ ਹੈਗੀਆਂ ਏ ਹੁਣ ਅੱਜ ਕੱਲ੍ਹ ਥੋੜ੍ਹਾ ਕੁ ਹਫਤੇ ਹੋਏ ਮਤਲਬ ਜਿੱਦਾਂ ਕਿ ਮੈਮ ਦੇਖ ਲਓ ਦੋ ਤਿੰਨ ਹਫਤੇ ਹੋਏ ਹੈ ਦੋ ਤਿੰਨ ਹਫਤਿਆਂ ਤੋਂ ਮੈਮ ਕਿਰਾਇਆ ਵੀ ਵੱਧ ਗਿਆ ਏ ਮਤਲਬ ਜੇ ਤੁਸੀਂ ਦੇਖ ਲਓ ਮਤਲਬ ਚੰਡੀਗੜ੍ਹ ਦੇ ਇੱਥੇ ਤੋਂ ਚੰਡੀਗੜ੍ਹ ਦਾ ਹੀ ਦੇਖ ਲਓ ਪਹਿਲਾਂ ਮੇਰੇ ਖਿਆਲ 'ਚ ਸੱਤਰ ਰੁਪਏ ਲੱਗਦੇ ਹੁੰਦੇ ਸੀਗੇ ਹੁਣ ਮੇਰੇ ਖਿਆਲ 'ਚ ਜ਼ਿਆਦਾ ਹੋ ਗਏ ਆ ਚੰਡੀਗੜ੍ਹ ਦਾ ਕਿਰਾਇਆ ਵੇ ਔਰ ਜੇ ਤੁਸੀਂ ਹਾਂਜੀ ਟਰੇਨ ਨਹੀਂ ਨਹੀਂ ਮੈਮ ਟਰੇਨ ਨਹੀਂ ਨਹੀਂ ਮੈਮ ਟਰੇਨ ਦਾ ਕਿਰਾਇਆ ਠੀਕ ਹੈ ਟਰੇਨ ਦਾ ਕਿਰਾਇਆ ਬੱਸਾਂ ਨਾਲੋਂ ਘੱਟ ਹੈ ਵੈਸੇ ਪਰ ਬੱਸਾਂ ਮਤਲਬ ਤੁਹਾਨੂੰ ਜੇ ਤੁਸੀਂ ਕਿਤੇ ਲੋਕਲ ਰੁਕਣਾ ਹੋਵੇ ਨਾ ਬਸਾਂ ਮਤਲਬ ਲੋਕਲ ਨਹੀਂ ਰੁਕਦੀਆਂ ਜਿੱਦਾਂ ਤੁਸੀਂ ਇੱਥੇ ਤੋਂ ਜਾਓਂਗੇ ਤਾਂ ਸਿੱਧਾ ਮਤਲਬ ਉਹ ਜਿਹੜੀ ਜਗ੍ਹਾ ਜਾਓਂਗੇ ਨਾ ਮਤਲਬ ਜੇ ਉੱਥੇ ਟਰੇਨ ਦੀ ਸਿਸਟਮ ਟਰੇਨ ਦੀ ਸਰਵਿਸ ਹੈਗੀ ਹੈ ਨਾ ਤਾਂ ਹੀ ਉਹ ਟਰੇਨ ਉੱਥੇ ਜਾਵੇਗੀ ਜੇ ਟਰੇਨ ਦੀ ਸਰਵਿਸ ਨਹੀਂ ਹੈ ਉੱਥੇ ਫਿਰ ਤੁਹਾਨੂੰ ਫੇਰ ਅੱਗੇ ਉੱਥੇ ਜਾਣ ਦੇ ਲਈ ਜਿਹੜੀ ਜਗ੍ਹਾ ਤੁਸੀਂ ਜਾਓਂਗੇ ਤੁਹਾਨੂੰ ਫਿਰ ਉੱਥੇ ਕੋਈ ਬੱਸ ਜਾਂ ਟੈਕਸੀ ਟੁਕਸੀ ਵਗੈਰਾ ਕਰਨੀ ਪਵੇਗੀ ਹਾਂਜੀ ਮਤਲਬ ਠੀਕ ਠੀਕ ਹੀ ਆ ਹਾਂਜੀ ਮੈਮ ਹਾਂਜੀ ਠੀਕ ਹੈ ਚਲੋ ਠੀਕ ਹੈ ਮੈਮ ਫਿਰ ਓਕੇ ਬਾਏ